ਹਾਂਜੀ ਦੋਸਤੋ ਅਸੀਂ ਬਹੁਤ ਸਾਰੇ ਵਿਅੰਜਨ ਜਿਹੜੇ ਹੈਗੇ ਆ ਖਾਣ ਦੇ ਸ਼ੌਕੀਨ ਹੁੰਦੇ ਹਨ ਇਸ ਲਈ ਮੈਨੂੰ ਮੇਰੇ ਘਰ ਦੇ ਵਿੱਚ ਵੀ ਮੇਰਾ ਬੇਟਾ ਵੀ ਕਹਿੰਦਾ ਰਹਿੰਦਾ ਹੈ ਕਿ ਮੈਨੂੰ ਮੰਮਾ ਇਹ ਬਣਾ ਦਿਉ ਇਹ ਬਣਾ ਦਿਉ ਤਾਂ ਇਸ ਲਈ ਮੈਂ ਬਹੁਤ ਸਾਰੀਆਂ ਚੀਜ਼ਾਂ ਜਿਹੜੀ ਹੈਗੀਆਂ ਟਰਾਈ ਕਰਦੀ ਰਹਿੰਦੀ ਹਾਂ ਲੇਕਿਨ ਇੱਕ ਵਾਰੀ ਕੀ ਹੋਇਆ ਕਿ ਮੈਂ ਸੋਚਿਆ ਕਿ ਅੱਜ ਮੈਂ ਚਲੋ ਡੋਸਾ ਬਣਾਇਆ ਜਾਵੇ ਤਾਂ ਉਹ ਡੋਸਾ ਬਣਾਉਣ ਦੇ ਵਿੱਚ ਜੋ ਮੈਨੂੰ ਮਤਲਬ ਸਾਹਮਣਾ ਕਰਨਾ ਪਿਆ ਮੁਸ਼ਕਲਾਂ ਦਾ ਉਹ ਮੈਂ ਦੱਸ ਨਹੀਂ ਸਕਦੀ ਕਿਉਂਕਿ ਉਹ ਮੈਂ ਡੋਸਾ ਜਿਹੜਾ ਹੈਗਾ ਮੇਰਾ ਬਣ ਹੀ ਨਹੀਂ ਪਾਇਆ ਪਤਾ ਨਹੀਂ ਤਾਂ ਉਸਦਾ ਜਿਹੜਾ ਉਹ ਬੈਟਰ ਬਣਿਆ ਸੀ ਉਹ ਨਹੀਂ ਸੀ ਪੂਰਾ ਚੰਗੀ ਤਰ੍ਹਾਂ ਬਣਿਆ ਹੋਇਆ ਪਤਾ ਨਹੀਂ ਕੀ ਪਰੌਬਲਮ ਆਈ ਉਹਦੇ ਵਿੱਚ ਕਿ ਜਿਹੜਾ ਡੋਸਾ ਹੈ ਉਹ ਤਵੇ ਦੇ ਉੱਤੇ ਉਹ ਬਣ ਹੀ ਨਹੀਂ ਰਿਹਾ ਸੀ ਪਤਾ ਨਹੀਂ ਉਸ 'ਚ ਵਿੱਚੋਂ ਖਿੱਲਰ ਜਾਂਦਾ ਸੀ ਕਦੇ ਉਹ ਚਿੱਪਕ ਜਾਂਦਾ ਸੀ ਕੁਛ ਬਸ ਉਹ ਬਣ ਹੀ ਨਹੀਂ ਪਾਇਆ ਤਾਂ ਕਰਕੇ ਮੈਨੂੰ ਲੱਗਿਆ ਕਿ ਹੁਣ ਮੈਂ ਡੋਸਾ ਜਿਹੜਾ ਹੈਗਾ ਬਣਾਉਣ ਦਾ ਇਹ ਕਦੇ ਵੀ ਮੈਂ ਕੋਸ਼ਿਸ਼ ਨਹੀਂ ਕਰੂੰਗੀ ਇਹ ਹਮੇਸ਼ਾਂ ਮਾਰਕਿਟ ਤੋਂ ਹੀ ਆਰਡਰ ਕਰੂੰਗੀ